ਬਚਪਨ ਵਿੱਚ ਜਦੋਂ ਮੇਰੇ ਮਾਂ ਬਾਪਾਂ ਨੇ ਮੈਨੂੰ ਇਹ ਸਮਝਾਇਆ ਕਿ ਤਾਰੇ ਟੁੱਟਣ ਨਾਲ ਵੀ ਵਿਸ਼ ਪੂਰੀ ਹੁੰਦੀ ਆ ਤਾਂ ਮੈਂ ਜਦੋਂ ਵੀ ਅਕਸਰ ਤਾਰ ਓ ਹਰ ਰੋਜ਼ ਰਾਤ ਨੂੰ ਕੋਠੇ 'ਤੇ ਜਾ ਕੇ ਤਾਰਿਆਂ ਨੂੰ ਦੇਖਿਆ ਕਰਦੀ ਸੀ ਤਾਂ ਜਦੋਂ ਵੀ ਮੈਨੂੰ ਕੋਈ ਟੁੱਟਿਆ ਹੋਇਆ ਤਾਰਾ ਦਿਖਦਾ ਸੀ ਤਾਂ ਮੈਂ ਇਹ ਵਿਸ਼ ਮੰਗਦੀ ਸੀ ਵੀ ਤਾਰਿਆਂ ਨੂੰ ਦੇਖਣ ਨਾਲ ਕਹਿੰਦੇ ਸੀ ਵਿਸ਼ ਪੂਰੀ ਹੁੰਦੀ ਆ ਪਰ ਅਕਸਰ ਜ਼ਿੰਦਗੀ ਵਿੱਚ ਮੇਰੀ ਕੋਈ ਵਿਸ਼ ਪੂਰੀ ਨਹੀਂ ਹੋਈ ਜਦੋਂ ਜਿਹੜੀਆਂ ਮੈਂ ਵਿਸ਼ ਮੰਗੀਆਂ ਸੀ ਤਾਰੇ ਟੁੱਟਦੇ ਹੋਏ ਨੂੰ ਦੇਖ ਕੇ ਜੇਕਰ ਮੈਂ ਇਸ ਕਾ ਇਹ ਇੱਕ ਤਰ੍ਹਾਂ ਦੀ ਮਿੱਥ ਹੀ ਸੀਗੀ ਜੇਕਰ ਮੈਂ ਕਹਾਣੀ ਦੀ ਗੱਲ ਕਰਾਂ ਤਾਂ ਇਹ ਮੈਨੇ ਇੱਕ ਫਿਲਮ ਵਿੱਚ ਦੇਖਿਆ ਸੀ ਤਾਰਿਆਂ ਦੀ ਫਿਲਮ ਸੀ ਉਸ ਵਿੱਚ ਮੈਨੇ ਉਹ ਫਿਲਮ ਦੇਖੀ ਸੀ ਤਾਂ ਮੇਰੀ ਇਸ ਵਾਰ ਤਾਰਿਆਂ ਦੀ ਤਾਰਿਆਂ ਨਾਲ ਫਿਲਮ ਨੂੰ ਦੇਖ ਕੇ ਤਾਰਿਆਂ ਬਾਰੇ ਮੇਰੀ ਨੌਲੇਜ ਹੋਰ ਵੱਧ ਗਈ ਤਾਂ ਕਰਕੇ ਫਿਰ ਮੈਨੂੰ ਫਿਰ ਮੇਰਾ ਤਾਰਿਆਂ ਵਿੱਚ ਇੰਟਰਸਟ ਪੈਦਾ ਹੋ ਗਿਆ ਤਾਂ ਕਰਕੇ ਮੈਨੂੰ ਤਾਰੇ ਬਹੁਤ ਹੀ ਪਸੰਦ ਆਉਣ ਲੱਗ ਗਏ